ਪੰਜਾਬੀ ਖੇਤਰ ਦੀਆਂ ਉਪਭਾਸ਼ਾ ਕਾਫੀ ਹਨ ਉਹਨਾਂ ਵਿੱਚੋਂ ਪੁਆਧੀ ਮਲਵਈ ਮਾਝੀ ਦੁਆਬੀ ਪੁਆਧ ਵਾਲੇ ਬੋਲਦੇ ਨੇ ਯੋ ਕਰ ਕਿਆ ਕਰ ਰਿਹਾ ਭਾਈ ਮਾਰੇ ਧਾਰੇ ਲਾਈ ਜਾਹਾ ਯੋ ਕਿਆ ਕਰੀ ਜਾਹਾ ਪੁਆਧੀ ਬਾਈ ਐਂ ਬੋਲੀ ਜਾਂਦੀ ਔਰ ਗੁਰਦਾਸਪੁਰ ਵਾਲੇ ਜਿਹੜੇ ਮ ਮਾਲਵੇ ਸੈਡ ਦੇ ਹੈ ਓ ਕੀ ਕਨ ਡਿਆ ਗਾੜੀ ਆ ਜਾ ਉਹ ਐਦਾਂ ਬੋਲਦੇ ਆ